ਮੈਂ ਅੰਸ਼ੁਲ ਮੈਂ ਪਠਾਨਕੋਟ ਦਾ ਰਹਿਣ ਵਾਲਾ ਹਾਂ ਜੀ ਹਾਂ ਮੇਰੇ ਕੋਲ ਧਾਰਮਿਕ ਅਭਿਆਸਾਂ ਨਾਲ ਸੰਬੰਧਿਤ ਗੀਤ ਹਨ ਕਿਉਂਕਿ ਸਭ ਤੋਂ ਪਹਿਲਾਂ ਮੈਂ ਤਾਂ ਇੱਕ ਧਾਰਮਿਕ ਬੰਦਾ ਹਾਂ ਅਤੇ ਨਾਲੇ ਮੈਂ ਤੁਹਾਨੂੰ ਇਹ ਦੱਸ ਦੇਵਾਂ ਕਿ ਮੈਂ ਹਿੰਦੂ ਹੈਗਾ ਅਤੇ ਮੈਂ ਹਰ ਦੇਵੀ ਦੇਵਤਿਆਂ ਨੂੰ ਇੱਕੋ ਨਜ਼ਰੀਏ ਨਾਲ ਵੇਖਦਾ ਕਿਉਂਕਿ ਉਹ ਕਿਹਾ ਜਾਂਦਾ ਨਾ ਕਿ ਰੱਬ ਇੱਕ ਹੀ ਹੈ ਤਾਂ ਇਸ ਤੋਂ ਇਲਾਵਾ ਜੇ ਮੈਂ ਗੱਲ ਕਰਾਂ ਕਿ ਮੈਨੂੰ ਕਿਹੜਾ ਗੀਤ ਪਸੰਦ ਹੈ ਅਤੇ ਕਿਉਂ ਤਾਂ ਜੇ ਦੇਖਿਆ ਜਾਵੇ ਇੱਦਾਂ ਧਾਰਮਿਕ ਅਭਿਆਸਾਂ ਨਾਲ ਜੁੜੇ ਤਾਂ ਬਹੁਤ ਗੀਤ ਹਨ ਪਰ ਜੇ ਮੈਂ ਗੱਲ ਕਰਾਂ ਕਿ ਕੁਝ ਐਸੇ ਗੀਤ ਹੁੰਦੇ ਹਨ ਜਿਸ ਨੂੰ ਸੁਣ ਕੇ ਵੱਖਰਾ ਹੀ ਲੱਗਦਾ ਜਿਵੇਂ ਕਿ ਹਨੂੰਮਾਨ ਚਾਲੀਸਾ ਹੋ ਗਿਆ ਜਾਂ ਫਿਰ ਸ਼ਿਵ ਤਾਂਡਵ ਦਾ ਸਰੋਤਮ ਹੋ ਗਿਆ ਅਤੇ ਜਿੱਦਾਂ ਹਨੂੰਮਾਨ ਚਾਲੀਸਾ ਦੀ ਮੈਂ ਗੱਲ ਕੀਤੀ ਹੈ ਤਾਂ ਉਹ ਸੁਣ ਕੇ ਇੱਕ ਵੱਖਰਾ ਜੋਸ਼ ਭਰ ਜਾਂਦਾ ਆਪਣੇ ਆ ਅੰਦਰ ਤਾਂ ਜਿ ਜਦੋਂ ਮੈਂ ਵੀ ਉਸ ਨੂੰ ਸੁਣਦਾ ਹਾਂ ਤਾਂ ਇੱਕ ਵੱਖਰਾ ਜਿਹਾ ਮਤਲਬ ਅੰਦਰ ਜੋਸ਼ ਦਿਖਦਾ ਇੱਕ ਵੱਖਰਾ ਜਿਹਾ ਅਹਿਸਾਸ ਹੁੰਦਾ ਕਿਉਂਕਿ ਉਹ ਸੁਣ ਕੇ ਇ ਇੰਝ ਲੱਗਦਾ ਕਿ ਬਿਲਕੁਲ ਆਰਾਮ ਮਿਲਦਾ ਮਤਲਬ ਕਿ ਭਗਤੀ ਕਰਨ ਦਾ ਨਜ਼ਾਰਾ ਆਉਂਦਾ ਧੰਨਵਾਦ